ਮੈਨੂੰ ਲੱਗਦਾ ਹੈ ਕਿਸੇ ਰਾਜ ਦੀ ਪਛਾਣ ਉਸਦੇ ਆਪ ਦਾ ਸੱਭਿਆਚਾਰਕ ਪਹਿਰਾਵਾ ਅਤੇ ਆਪਦੀ ਭਾਸ਼ਾ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਪੰਜਾਬੀ ਭਾਰਤ ਦੇ ਰਾਜ ਪੰਜਾਬ ਦੀ ਮੂਲ ਭਾਸ਼ਾ ਹੈ ਅਤੇ ਪੰਜਾਬ ਰਾਜ ਦੀ ਸੱਭਿਆਚਾਰ ਪਛਾਣ ਵਿੱਚ ਪੰਜਾਬੀ ਭਾਸ਼ਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸੰਨ ਉੱਨੀ ਸੌ ਸੰਤਾਲੀ ਵਿੱਚ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਮਿਲਿਆ ਪੰਜਾਬੀ ਭਾਸ਼ਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਪੰਜਾਬੀ ਲਗਭਗ ਇੱਕ ਸੌ ਤੇਤੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ਾਂ ਵਿੱਚ ਮਾਣ ਅਤੇ ਸਤਿਕਾਰ ਨਾਲ ਬੋਲਿਆ ਜਾਂਦਾ ਹੈ